ਹਾਈਕ ਕਰਨ ਲਈ ਮਨਪਸੰਦ ਜਗ੍ਹਾ ਮੇਰੀ ਮਨਸੂਰੀ ਹੈ ਮੈਂ ਮਸੂਰੀ 'ਤੇ ਗਈ ਵੀ ਹੋਈ ਹਾਂ ਵਿੱਚ ਹਾਈਕ ਕਰਨ ਦਾ ਬਹੁਤ ਮਜ਼ਾ ਆਉਂਦਾ ਵਾ ਉੱਥੇ ਘੁੰਮਣ ਦਾ ਬਹੁਤ ਮਜ਼ਾ ਆਉਂਦਾ ਵਾ ਉੱਥੇ ਹਾਈਕ ਕਰਨ ਦਾ ਬਹੁਤ ਮਜ਼ਾ ਆਉਂਦਾ ਕਿਉਂਕਿ ਪਹਾੜ ਏਰੀਆ ਉੱਥੇ ਪਹਾੜਾਂ 'ਚ ਘੁੰਮਣ ਦਾ ਮਜ਼ਾ ਆਉਂਦਾ ਵਾ ਇੱਕ ਵੈਸੇ ਵੀ ਸਾਡੇ ਅੰਮ੍ਰਿਤਸਰ 'ਚ ਵੈਸੇ ਇੰਨੀ ਗਰਮੀ ਆ ਤਾਂ ਉੱਥੇ ਮਨਸੂਰੀ ਵਿੱਚ ਠੰਡ 'ਚ ਘੁੰਮਣ ਦਾ ਮਜ਼ਾ ਆਉਂਦਾ ਵਾ ਬਰਫ਼ੀਲੇ ਪਹਾੜ ਦੇਖਣ ਦਾ ਬੜਾ ਮਜ਼ਾ ਆਉਂਦਾ ਵਾ ਬਰਫ਼ੀਲੇ ਪਹਾੜਾਂ 'ਚ ਘੁੰਮਣ ਦਾ ਖੇਡਣ ਦਾ ਵਧੀਆ ਹੁੰਦਾ ਹੈ ਅਸੀਂ ਉੱਥੇ ਪਹਾੜਾਂ ਵਿੱਚ ਜਾ ਕੇ ਫੋਟੋਆਂ ਖਿੱਚਣ ਦਾ ਮੈਮਰੀਜ਼ ਬਣਾਉਣ ਦਾ ਆਪਣੀ ਰੱਖਣ ਦਾ ਵਧੀਆ ਤਰੀਕਾ ਹੈ ਮਨਸੂਰੀ ਵਿੱਚ ਹਾਈਕ ਉਹ ਉੱਥੇ ਐਡਵੈਂਚਰ ਕਰਨ ਦਾ ਕਿੰਨਾ ਮਜ਼ਾ ਆਉਂਦਾ ਉੱਥੇ ਟਰੈਕਿੰਗ ਔਰ ਵੀ ਕਿੰਨੀਆਂ ਚੀਜ਼ਾਂ ਆਂ ਜੋ ਕਿ ਅਸੀਂ ਕਰਦੇ ਹਾਂ ਜਿੱਦਾਂ ਜਿਪਲਾਈਨ ਰਾਫਟੀਨ ਟਰੈਕਿੰਗ ਉੱਥੇ ਟੈਂਟ ਲਾ ਕੇ ਅਸੀਂ ਸੌਂਦੇ ਹਾਂ ਰਾਤੀਂ ਅੱਗ ਬਾਲ ਕੇ ਅਸੀਂ ਗੇਮਸ ਖੇਲਦੇ ਹਾਂ ਨਾਲ ਅਸੀਂ ਕਿੰਨਾ ਕੁਛ ਉੱਥੇ ਕਰ ਸਕਦੇ ਹਾਂ ਪਹਾੜਾਂ ਵਿੱਚ ਬਹਿ ਕੇ ਪਹਾੜਾਂ ਵਿੱਚ ਅਸੀਂ ਉੱਥੇ ਆਪਣੀ ਮੈਮਰੀਜ਼ ਬਣਾਉਂਦੇ ਆਂ ਫੋਟੋਆਂ ਖਿੱਚਦੇ ਹਾਂ ਆਪਣੀ ਯਾਦਗਾਰ ਬਣਾਂਦੇ ਹਾਂ ਉੱਥੇ ਅਸੀਂ ਨਾਲ ਨਾਲ ਉੱਥੇ ਬਰਫੀਲੇ ਪਹਾੜ ਵੇਖਣ ਦਾ ਕਿੰਨਾ ਮਜ਼ਾ ਆਉਂਦਾ ਵਾ ਅਸੀਂ 'ਚ ਕਦੀ ਬਰਫ ਦੇਖੀ ਹੋ ਨਹੀਂ ਆ ਇਸ ਕਰਕੇ ਅਸੀਂ ਉੱਥੇ ਜਾਂਦੇ ਆਂ ਬਰਫ ਦੇਖ ਸਕੀਏ ਬਰਫ ਨਾਲ ਖੇਡ ਸਕੀਏ ਬਰਫ 'ਚ ਘੁੰਮ ਸਕੀਏ ਬਰਫ 'ਚ ਆਪਣੀ ਮੈਮਰੀਜ਼ ਬਣਾ ਸਕੀਏ ਅਤੇ ਉੱਥੇ ਅਸੀਂ ਕਿੰਨਾ ਮਜ਼ਾ ਕਰਦੇ ਹਾਂ ਬਰਫ ਨੂੰ ਸਨੋਮ ਸਨੋ ਮੈਨ ਬਣਾ ਕੇ ਅਸੀਂ ਉੱਥੇ ਖੇਡਦੇ ਹਾਂ ਬਰਫ ਵਿੱਚ ਅਤੇ ਹੋਰ ਵੀ ਕਾਫੀ ਕੁਛ ਹੈ ਜੋ ਕਿ ਅਸੀਂ ਮਨਸੂਰੀ ਵਿੱਚ ਹਾਈਕ ਕਰ ਸਕਦੇ ਹਾਂ ਮੈਨੂੰ ਜਦੋਂ ਅਸੀਂ ਉੱਥੇ ਮਨਸੂਰੀ ਵਿੱਚ ਹੁੰਦੇ ਹਾਂ ਅਤੇ ਸਨਸੈਟ ਜਦੋਂ ਹੁੰਦਾ ਉਹਨੂੰ ਦੇਖਣ ਦਾ ਕਿੰਨਾ ਮਜ਼ਾ ਆਉਂਦਾ ਵਾ ਉਹਦੀ ਫੋਟੋਆਂ ਖਿੱਚਣ ਦਾ ਕਿੰਨਾ ਵਧੀਆ ਲੱਗਦਾ ਉਹ